ਇੱਕ ਖੂਹ ਵਿੱਚੋਂ ਪਾਣੀ ਬਹੁਤ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ ਪੁਰਾਣੇ ਸਮਿਆਂ ਵਿੱਚ ਖੂਹ 'ਚੋਂ ਪਾਣੀ ਕੱਢਣ ਦੇ ਲਈ ਖੂਹ ਦੇ ਉੱਪਰ ਮੌਣ ਬਣੀ ਹੁੰਦੀ ਸੀ ਉਸ ਦੇ ਉੱਪਰ ਇੱਕ ਫਿਰਕੀ ਲੱਗੀ ਹੁੰਦੀ ਸੀ ਔਰ ਇੱਕ ਰੱਸਾ ਨੀਚੇ ਲਮਕਾਇਆ ਜਾਂਦਾ ਸੀ ਰੱਸੇ ਨਾਲ ਬਾਲਟੀ ਬੰਨ੍ਹੀ ਹੁੰਦੀ ਸੀ ਜਦੋਂ ਉਹਨੂੰ ਹੌਲੀ ਹੌਲੀ ਰੱਸਾ ਨੀਚੇ ਛੱਡਿਆ ਜਾਂਦਾ ਸੀ ਤਾਂ ਬਾਲਟੀ ਭਰ ਜਾਂਦੀ ਸੀ ਜਦੋਂ ਪਾਣੀ ਨਾਲ ਲੱਗ ਜਾਂਦੀ ਸੀ ਤਾਂ ਫਿਰ ਧੀਰੇ ਧੀਰੇ ਹੌਲੀ ਹੌਲੀ ਉਹ ਰੱਸੇ ਨੂੰ ਬਾਹਰ ਖਿੱਚਿਆ ਜਾਂਦਾ ਸੀ ਉੱਪਰ ਵੱਲ ਨੂੰ ਤਾਂ ਉਹ ਜਿਹੜੀ ਇੱਕ ਫਿਰਕੀ ਦੇ ਉੱਪਰ ਰੱਸਾ ਆਪਣੇ ਆਪ ਬਾਹਰ ਵੱਲ ਆ ਜਾਂਦਾ ਸੀ ਔਰ ਬਾਲਟੀ ਇੱਕ ਟਾਈਮ ਆਉਂਦਾ ਸੀ ਕਿ ਬਾਲਟੀ ਉੱਪਰ ਭਰ ਕੇ ਆ ਜਾਂਦੀ ਸੀ ਅਤੇ ਅਸੀਂ ਉਸਨੂੰ ਪਾਣੀ ਨੂੰ ਬਾਹਰ ਕੱਢ ਕੇ ਸਟੋਰ ਕਰ ਲੈਂਦੇ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਕੀ ਹੈ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਟਿੰਡਾਂ ਦੀ ਵਰਤੋਂ ਕੀਤੀ ਗਈ ਉਸ ਦੇ ਉੱਪਰ ਬੈਲ ਜੋੜੇ ਜਾਂਦੇ ਸੀ ਬੈਲ ਚਾਰ ਚੁਫੇਰੇ ਖੂਹ ਦੇ ਘੁੰਮਦੇ ਸੀ ਉਹ ਟਿੰਡਾਂ ਬਾਹਰ ਆਉਂਦੀਆਂ ਸੀ ਪਾਣੀ ਦੀਆਂ ਭਰ ਭਰ ਕੇ ਉਸ ਤੋਂ ਬਾਅਦ ਅੱਜ ਕੱਲ੍ਹ ਆਧੁਨਿਕ ਤਕਨੀਕ ਦੇ ਨਾਲ ਪਾਈਪ ਖੂਹ ਦੇ ਵਿੱਚ ਫਿੱਟ ਕਰ ਦਿੱਤੀ ਜਾਂਦੀ ਹੈ ਉੱਪਰ ਉਹਦੇ ਵਿੱਚ ਤੇ ਮੋਟਰ ਰੱਖ ਦਿੱਤੀ ਜਾਂਦੀ ਹੈ ਔਰ ਪਾਣੀ ਬਾਹਰ ਕੱਢਿਆ ਜਾਂਦਾ ਅੱਜ ਕੱਲ੍ਹ ਸਮਰਸੀਵੱਲ ਵੀ ਪਾਏ ਜਾਂਦੇ ਆ ਪਾਈਪ ਦੇ ਵਿੱਚ ਹੀ ਮੋਟਰ ਪੈ ਜਾਂਦੀ ਔਰ ਪਾਣੀ ਨੂੰ ਬਾਹਰ ਕੱਢ ਲਿਆ ਜਾਂਦਾ ਹੈ